ਮੈਂ ਆਪਣੇ ਪਰਿਵਾਰ ਨਾਲ ਪਿਕਨਿਕ ਮਨਾਉਣ ਲਈ ਜਾਂ ਆਪਣੇ ਦੋਸਤਾਂ ਨਾਲ ਪਿਕਿੰਗ ਮਨਾਉਣ ਲਈ ਟਿੱਬੀ ਸਾਹਿਬ ਜਾਂ ਫਿਰ ਆਪਣੇ ਰਣਜੀਤ ਸਿੰਘ ਪਾਰਕ 'ਚ ਜਾਂਦੀ ਹਾਂ ਕਿਉਂਕਿ ਉੱਥੇ ਜਾ ਕੇ ਖੇਡਣ ਨੂੰ ਵੀ ਹੈ ਕਿ ਅਸੀਂ ਉੱਥੇ ਖੇਡ ਸਕਦੇ ਹਾਂ ਖੁੱਲ੍ਹੇ ਹੁੰਦੇ ਕਿਉਂਕਿ ਪਾਰਕ ਵਗੈਰਾ ਜੋ ਕਿ ਟਾਈਮ ਵੀ ਉੱਥੇ ਕਾਫੀ ਟਾਈਮ ਅਸੀਂ ਜਦੋਂ ਵੀ ਮੰਮਾ ਪਾਪਾ ਨੂੰ ਛੁੱਟੀ ਹੋਵੇ ਜਾਂ ਫੈਮਲੀ 'ਚ ਵੀ ਛੁੱਟੀ ਹੋਵੇ ਤਾਂ ਅਸੀਂ ਉੱਥੇ ਜਾਂਦੇ ਆ ਕਈ ਵਾਰ ਤਾਂ ਮੰਮਾ ਖੁਦ ਹੀ ਘਰ ਤੋਂ ਲੰਚ ਬਣਾ ਕੇ ਲੈ ਜਾਂਦੇ ਹਾਂ ਕਿਉਂਕਿ ਬਾਹਰ ਦਾ ਖਾਣ ਨਾਲੋਂ ਚੰਗਾ ਏ ਕਿ ਘਰ ਦਾ ਖਾਵੇ ਕਿਉਂਕਿ ਬਾਹਰ ਦਾ ਖਾ ਕੇ ਅਸੀਂ ਬਿਮਾਰ ਵੀ ਹੋ ਸਕਦੇ ਹਾਂ ਅਤੇ ਮੰਮਾ ਖੁਦ ਹੀ ਘਰ ਬਣਾ ਕੇ ਲੈ ਕੇ ਜਾਂਦੇ ਆ ਕਈ ਵਾਰ ਅਸੀਂ ਲੰਚ ਹੋ ਗਿਆ ਡਿਨਰ ਹੋ ਗਿਆ ਬਾਹਰ ਹੀ ਕਰਕੇ ਆਉਂਦੇ ਹਾਂ ਕਿਉਂਕਿ ਅਸੀਂ ਜਦੋਂ ਵੀ ਪਿਕਨਿਕ ਮਨਾਉਣ ਜਾਂਦੇ ਹਾਂ ਫਿਰ ਘਰ ਘੱਟ ਏ ਆਉਂਦੇ ਹਾਂ ਜਲਦੀ ਨਹੀਂ ਆਉਂਦੇ ਬਾਹਰ ਅਸੀਂ ਉੱਥੇ ਜਾ ਕੇ ਉੱਥੇ ਘੁੰਮਦੇ ਫਿਰਦੇ ਹਾਂ ਉੱਥੇ ਖੇਡਦੇ ਹਾਂ ਜਾਂ ਫਿਰ ਉੱਥੋਂ ਦੀ ਕੋਈ ਵੀ ਐਕਟੀਵਿਟੀਜ਼ ਕਰਦੇ ਹਾਂ ਜੋ ਕਿ ਬਹੁਤ ਚੰਗੀਆਂ ਹੁੰਦੀਆਂ ਹਨ ਜਾਂ ਫਿਰ ਅਸੀਂ ਖੇਲ ਖੁਲ ਲੈਂਦੇ ਹਾਂ ਕੋਈ ਉੱਥੇ ਬੱਚੇ ਵਗੈਰਾ ਹੁੰਦੇ ਆ ਉੱਥੇ ਝੂਲੇ ਲੱਗੇ ਹੁੰਦੇ ਆ ਰਣਜੀਤ ਸਿੰਘ ਪਾਰਕ ਉੱਥੇ ਆਪਾਂ ਝੂਲੇ ਵਗੈਰਾ ਲੈਣ ਲੱਗ ਪੈਂਦੇ ਹਾਂ ਫੋਟੋਜ਼ ਵਗੈਰਾ ਕਲਿੱਕ ਕਰਨ ਲੱਗ ਪੈਂਦੇ ਹਾਂ